ਸਤਿ ਸ਼੍ਰੀ ਅਕਾਲ ਭਾਅ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਸਾਰੇ ਬੱਚੇ ਠੀਕ ਨੇ ਹਾਂਜੀ ਹਾਂਜੀ ਸਭ ਵਧੀਆ ਬਸ ਅਸੀਂ ਦੋਵੇਂ ਇਕੱਲੇ ਰਹਿ ਗਏ ਹਾਂ ਬੱਚੇ ਬਾਹਰ ਆ ਹਾਂਜੀ ਹਾਂਜੀ ਇੱਥੇ ਉੱਧਰ ਕੋਈ ਜੋਬ ਨਹੀਂ ਮਿਲੀ ਟਰਾਈ ਕੀਤਾ ਬੱਚਿਆਂ ਨੇ ਕੁਛ ਮੇ ਜੋਬ ਨਹੀਂ ਮਿਲੀ ਫਿਰ ਬਸ ਬਾਹਰ ਭੇਜ ਦਿੱਤੇ ਹੁਣ ਉੱਥੇ ਹੀ ਨੇ ਵਧੀਆ ਕਮਾਉਂਦੇ ਖਾਂਦੇ ਆ ਹਾਂਜੀ ਹਾਂਜੀ ਬਸ ਵਧੀਆ ਨੇ ਹਾਂਜੀ ਹਾਂਜੀ ਹਾਂਜੀ ਹੋਰ ਨਹੀਂ ਨਹੀਂ ਨਹੀਂ ਜੀ ਬਿਲਕੁਲ ਨਹੀਂ ਹੈਗਾ ਕਿਉਂਕਿ ਕੋਈ ਵੀ ਬੱਚੇ ਇੰਨੇ ਫੋਰਮ ਭਰਦੇ ਨੇ ਕੋਈ ਜੋਬ ਆਉਂਦੀ ਨਹੀਂ ਮਿਲਦੀ ਨਹੀਂ ਹੈਗੀ ਕੋਂਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਤੁਹਾਡੇ ਬੱਚਿਆਂ ਦਾ ਕੀ ਹਾਲ ਚਾਲ ਹੈ ਅੱਛਾ ਅੱਛਾ ਨਹੀਂ ਨਹੀਂ ਠੀਕ ਆ ਬਸ ਜਦੋਂ ਕੋਈ ਜੋਬ ਹੀ ਨਹੀਂ ਮਿਲਦੀ ਫਿਰ ਬੱਚਿਆਂ ਦਾ ਕੁਛ ਸੋਚਣਾ ਹੀ ਪੈਂਦਾ

ਅੱਛਾ ਅੱਛਾ ਚਲੋ ਵਧੀਆ ਵਧੀਆ ਬੱਚਿਆਂ ਦਾ ਫਿਊਚਰ ਬਣ ਜੁਗਾ ਹਾਂਜੀ ਹਾਂਜੀ ਮਿਲ ਜਾਂਦਾ ਬਾਕੀ ਰਿਸੈਸ਼ਨ ਵੀ ਚੱਲ ਰਹੀ ਹੈ ਵਿੱਚ ਵਿੱਚ ਜੇ ਕੰਮ ਰੁਕ ਵੀ ਜਾਂਦਾ ਦੋਨਾਂ ਦਾ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਮ ਹਮ ਸਾਰੇ ਠੀਕ ਠਾਕ ਆ ਵਧੀਆ ਚਲੋ ਭੇਜੋ ਤੁਸੀਂ ਵੀ ਆਪਦੇ ਬੱਚਿਆਂ ਨੂੰ ਤਿਆਰੀ ਕਰੋ ਬਾਹਰ ਭੇਜਣ ਦੀ ਹਾਂਜੀ ਚਲੋ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ